ਸਾਡੇ ਜਿਹੜੇ ਘਰ ਹੈਗੀ ਹੈ ਹੁਣ ਤਾਂ ਅੱਜਕੱਲ੍ਹ ਤਾਂ ਮਤਲਬ ਬਿਜਲੀ ਤਾਂ ਪੂਰੀ ਰੈਗੂਲਰ ਆਉਂਦੀ ਹੈਗੀ ਆ ਪਰ ਫੇਰ ਵੀ ਵਿੱਚ ਵਿੱਚ ਕਿਸੇ ਨਾ ਕਿਸੇ ਕਾਰਨਾਂ ਕਰਕੇ ਬਿਜਲੀ ਦੇ ਕੱਟ ਲੱਗਦੇ ਰਹਿੰਦੇ ਹੈਗੇ ਜਿੱਦਾਂ ਹੁਣ ਮੰਨ ਲਉ ਕੋਈ ਹਨੇਰੀ ਚੱਲੀ ਜਾਂ ਕੁਛ ਹੋ ਗਿਆ ਉਹਦੇ ਕਰਕੇ ਉਹ ਤਾਂ ਕੁਦਰਤੀ ਆਫਤਾਂ ਇਹਦੇ ਵਿੱਚ ਕੋਈ ਵੀ ਕੁਛ ਨਹੀਂ ਕਰ ਸਕਦਾ ਹੈਗਾ ਇਹਦੇ ਵਿੱਚ ਆਪਾਂ ਇੱਕ ਚੰਗਾ ਮਤਲਬ ਸਿਸਟਮ ਡਿਵੈਲਪ ਕਰ ਸਕਦੇ ਹਾਂ ਜਿਹਦੇ ਨਾਲ ਮਤਲਬ ਹੈਗਾ ਹੈ ਜਿਹਦੇ ਨਾਲ ਆਪਾਂ ਬਿਜਲੀ ਦੇ ਕੱਟ ਹੈ ਜਿਹੜੇ ਘੱਟ ਤੋਂ ਘੱਟ ਲੱਗਣ ਹੈਗੇ ਹੈ ਇਹ ਤੋਂ ਇਲਾਵਾ ਜਿਹੜਾ ਹੈਗਾ ਹੈ ਆਪਾਂ ਜਿੱਦਾਂ ਹੁਣ ਦੇਖਿਆ ਜਾਵੇ ਜਿਹੜੇ ਬਿਜਲੀ ਦੇ ਕੱਟ ਲੱਗਦੇ ਹੈਗੇ ਉਹ ਜ਼ਿਆਦਾਤਰ ਜਿਹੜਾ ਜਿਸ ਜਿਨ੍ਹਾਂ ਜਿਨ੍ਹਾਂ ਸਮਿਆਂ 'ਚ ਮਤਲਬ ਜਿਨ੍ਹਾਂ ਟਾਈਮਾਂ ਜਿੱਦਾਂ ਬਿਜਲੀ ਉਹਦੀ ਖੇਤੀ ਦੇ ਖੇਤੀਬਾੜੀ ਦਾ ਉਹ ਕੀਤਾ ਜਾਂਦਾ ਹੈਗਾ ਹੈ ਫਸਲਾਂ ਬੀਜੀਆਂ ਜਾਂਦੀਆਂ ਫਸਲਾਂ ਦੀ ਬਿਜਾਈ ਕੀਤੀ ਜਾਂਦੀ ਹੈਗੀ ਹੈ ਉਹਨਾਂ ਟਾਈਮਾਂ ਜਿਹੜੇ ਬਿਜਲੀ ਦੇ ਜ਼ਿਆਦਾ ਕੱਟ ਲੱਗਦੇ ਹੈਗੇ ਹੈ ਗਰਮੀਆਂ ਵਿੱਚ ਬਾਕੀ ਤਾਂ ਜਿਹੜੇ ਆਪਾਂ ਅਦਰ ਮੌਸਮਾਂ ਵਿੱਚ ਦੇਖਿਆ ਜਾਵੇ ਤਾਂ ਉ ਰੈਗੂਲਰ ਦੀ ਤਰ੍ਹਾਂ ਬਿਜਲੀ ਚੱਲਦੀ ਰਹਿੰਦੀ ਹੈਗੀ ਹੈ